ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਉੱਤਰੀ ਭਾਰਤ ਬਾਰੇ ਦੱਸਿਆ ਜਾਏ ਤਾਂ ਉੱਤਰੀ ਭਾਰਤ ਵਿੱਚ ਜਿਸ ਤਰ੍ਹਾਂ ਕਿ ਰਾਜਮਾ ਚਾਵਲ ਬਹੁਤ ਪਸੰਦ ਹੁੰਦੇ ਆ ਲੋਕਾਂ ਨੂੰ ਇੱਥੇ ਧੁੱਪ ਅਤੇ ਛਾਂ ਵੀ ਹੁੰਦੀ ਹੈ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਸਿੱਖਣ ਵਾਸਤੇ ਇੱਥੇ ਉਤੱਰੀ ਭਾਰਤ ਵਿੱਚ ਔਰ ਜਿੱਦਾਂ ਕਿ ਦੱਖਣੀ ਭਾਰਤ ਵਿੱਚ ਵੀ ਗੱਲ ਕੀਤੀ ਜਾਏ ਤਾਂ ਦੱਖਣੀ ਭਾਰਤ ਵਿੱਚ ਲੋਕ ਪਹਿਨਾਵੇ ਨੂੰ ਲੈ ਕੇ ਜਿਸ ਤਰ੍ਹਾਂ ਧੋਤੀ ਕੁੜਤਾ ਪਸੰਦ ਹੈ ਉੱਧਰ ਧੁੱਪ ਜ਼ਿਆਦਾ ਹੁੰਦੀ ਹੈ ਅਤੇ ਸਾਡੇ ਭਾਰਤ ਵਿੱਚ ਛਾਂ ਧੁੱਪ ਵੀ ਹੁੰਦੀ ਹੈ ਪਹਿਨਾਵੇ ਬਾਰੇ ਦੱਸਿਆ ਜਾਏ ਸਾਡੇ ਭਾਰਤ ਵਿੱਚ ਜਿਸ ਤਰ੍ਹਾਂ ਕੁੜਤਾ ਪਜਾਮਾ ਪਸੰਦ ਮੁੰਡਿਆਂ ਨੂੰ ਔਰਤਾਂ ਨੂੰ ਸਲਵਾਰ ਸੂਟ ਪਸੰਦ ਹੈ ਭੋਜਨ ਵਿੱਚ ਇੱਧਰ ਜਿਸ ਤਰ੍ਹਾਂ ਕਿ ਹਾੱਟ ਖਾਣਾ ਖਾਂਦੇ ਆ ਸਾਡੇ ਇੱਥੇ ਪੰਜਾਬ ਵਿੱਚ ਰਾਜਮਾਹ ਸਾਗ ਤੁਹਾਡਾ ਜਿਸ ਤਰ੍ਹਾਂ ਕੜੀ ਚਾਵਲ ਜ਼ਿਆਦਾ ਤੋਂ ਜ਼ਿਆਦਾ ਪਸੰਦ ਕਰਦੇ ਆ ਮੌਸਮ ਦੀ ਬਾਰੇ ਦੱਸਿਆ ਜਾਏਗਾ ਤਾਂ ਮੌਸਮ ਉੱਧਰ ਉੱਤਰ ਭਾਰਤ ਵਿੱਚ ਮੌਸਮ ਜਿਸ ਤਰ੍ਹਾਂ ਕਿ ਧੁੱਪ ਛਾਂ ਜਿੱਥੇ ਹਰ ਚੀਜ਼ਾਂ ਦੇਖਣ ਨੂੰ ਮਿਲਦੀਆਂ ਜੇ ਦੱਖਣ ਭਾਰਤ ਬਾਰੇ ਦੱਸਿਆ ਜਾਏ ਤਾਂ ਉੱਥੇ ਬਸ ਧੁੱਪ ਹੀ ਰਹਿੰਦੀ ਹੈ ਇਹਨਾਂ ਦਾ ਅੰਤਰ ਇਹ ਹਨ ਕੱਪੜੇ ਪਾਉਣ ਦਾ ਵੀ ਬਹੁਤ ਜ਼ਿਆਦਾ ਅੰਤਰ ਹੁੰਦਾ ਵਿੱਚ ਵੀ ਇਹ ਅੰਤਰ ਹੈ ਥੈਂਕ ਯੂ ਸਰ ਓਕੇ